ਜਦੋਂ ਵੀ ਅਸੀਂ ਬਾਈਕ 'ਤੇ ਲੰਬੇ ਸਫ਼ਰ ਲਈ ਨਿਕਲਦੇ ਹਾਂ ਤਾਂ ਅਸੀਂ ਰਸਤੇ ਦੇ ਵਿੱਚ ਕੁਛ ਟਾਈਮ ਦੇ ਬਾਅਦ ਥੋੜ੍ਹੀ ਥੋੜ੍ਹੀ ਬਰੇਕ ਲੈਂਦੇ ਹੋਏ ਜਾਂਦੇ ਹਾਂ ਸਪੋਜ ਕਰੋ ਅਸੀਂ ਦਿੱਲੀ ਜਾਣਾ ਹੈ ਸਫ਼ਰ ਦਸ ਘੰਟੇ ਦਾ ਹੈ ਇੱਕ ਘੰਟੇ ਤੋਂ ਬਾਅਦ ਸੱਠ ਸੱਤਰ ਕਿਲੋਮੀਟਰ ਕੰਪਲੀਟ ਕਰਨ 'ਤੇ ਅਸੀਂ ਪੰਜ ਸੱਤ ਮਿਨਟ ਦੀ ਬਰੇਕ ਜ਼ਰੂਰ ਲੈਦੇ ਹਾਂ ਉਸ ਦਰਮਿਆਨ ਸਾਨੂੰ ਜਿਹੜੀ ਥਕਾਵਟ ਹੋਈ ਹੁੰਦੀ ਹੈ ਉਸ 'ਚ ਥੋੜ੍ਹੀ ਰੈਸਟ ਮਿਲ ਜਾਂਦੀ ਹੈ ਅਤੇ ਸਰੀਰ ਫਿਰ ਤਰੋ ਤਾਜ਼ਾ ਹੋ ਜਾਂਦਾ ਹੈ ਦੋ ਤਿੰਨ ਘੰਟੇ ਸਫ਼ਰ ਕਰਨ ਤੋਂ ਬਾਅਦ ਅਸੀਂ ਕੁਛ ਨਾ ਕੁਛ ਖਾਣਾ ਪੀਣਾ ਜ਼ਰੂਰ ਪਸੰਦ ਕਰਦੇ ਹਾਂ ਕੁਛ ਚੀਜ਼ਾਂ ਤਾਂ ਅਸੀਂ ਜ਼ਰੂਰਤ ਦੀਆਂ ਆਪਣੇ ਬੈਗ 'ਚ ਹੀ ਪਾਈਆਂ ਹੁੰਦੀਆਂ ਹਨ ਅਤੇ ਕੁਛ ਉੱਥੋਂ ਦਾ ਲੋਕਲ ਫੂਡ ਵਗੈਰਾ ਵੀ ਅਸੀਂ ਖਾ ਲੈਂਦੇ ਹਾਂ ਅਸੀਂ ਜ਼ਿਆਦਾ ਤਲਿਆ ਜਾਂ ਮਿੱਠਾ ਆਦਿ ਖਾਣਾ ਪਸੰਦ ਨਹੀਂ ਕਰਦੇ ਜ਼ਿਆਦਾ ਸਫ਼ਰ ਕਰਨ 'ਤੇ ਲੱਤ 'ਚ ਦਰਦ ਜਾਂ ਮੋਢੇ 'ਤੇ ਜਾਂ ਲੱਕ ਦੇ ਵਿੱਚ ਦਰਦ ਵੀ ਹੋਣ ਲੱਗ ਪੈਂਦਾ ਹੈ ਅਜਿਹੀ ਸੂਰਤ ਦੇ ਵਿੱਚ ਅਸੀਂ ਕੁਛ ਟਾਈਮ ਰੈਸਟ ਕਰਨਾ ਹੀ ਸਹੀ ਸਮਝਦੇ ਹਾਂ ਕਈ ਵਾਰ ਅਸੀਂ ਇਸ ਤੋਂ ਵੀ ਜ਼ਿਆਦਾ ਲੰਬੇ ਸਫ਼ਰ ਦਾ ਅਨੁਭਵ ਕਰ ਚੁੱਕੇ ਹਾਂ ਇੱਕ ਵਾਰ ਅਸੀਂ ਬਾਈਕ ਦੇ ਉੱਤੇ ਸ਼੍ਰੀ ਹੇਮਕੁੰਟ ਸਾਹਿਬ ਵੀ ਗਏ ਸੀ ਜੋ ਕਿ ਟੋਟਲ ਸਫ਼ਰ ਪੰਜ ਛੇ ਦਿਨ ਦਾ ਸੀ ਇਹ ਸਫ਼ਰ ਅਸੀਂ ਦੋ ਦੋ ਤਿੰਨ ਤਿੰਨ ਘੰਟੇ ਬਾਅਦ ਬਰੇਕ ਲੈਕੇ ਤਹਿ ਕੀਤਾ